ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਵੀਹ ਜਨਵਰੀ ਉੱਨੀ ਸੌ ਪੰਜਾਹ ਸਤਾਈ ਫ਼ਰਵਰੀ ਉੱਨੀ ਸੌ ਸੱਤਰ ਇੱਕ ਮਾਰਚ ਉੱਨੀ ਸੌ ਨੱਬੇ ਪੱਚੀ ਮਈ ਉਂ ਦੋ ਹਜ਼ਾਰ